ਲੋਰੀਆਂ ਲੋਰੀਆਂ ਕੀ ਹੁੰਦੀਆਂ ਨੇ ਇਸਦੇ ਵਿਸ਼ੇ ਕਿਹੜੇ ਹੁੰਦੇ ਹਨ ਲੋਰੀਆਂ ਪੁਰਾਣੇ ਸਮੇਂ ਵਿੱਚ ਲੋਰੀਆਂ ਦਾ ਮਤਲਬ ਇਹੀ ਹੁੰਦਾ ਸੀ ਕਿ ਬੱਚੇ ਜਦੋਂ ਸ ਰੋਂਦਾ ਹੁੰਦਾ ਸੀ ਛੋਟਾ ਬੱਚਾ ਤਾਂ ਉਹਨੂੰ ਸੁਲਾਉਣ ਵਾਸਤੇ ਮਾਂ ਲੋਰੀਆਂ ਦੀ ਮਦਦ ਲੈਂਦੀ ਸੀ ਤਾਂ ਲੋਰੀਆਂ ਸੁਣਾਉਦੀਆਂ ਸੀ ਅਤੇ ਲੋਰੀਆਂ ਗਾ ਕੇ ਉਹਨੂੰ ਸੁਣਾਉਣਾ ਅਤੇ ਬੱਚਾ ਚੁੱਪ ਕਰ ਜਾਂਦਾ ਸੀ ਲੋਰੀਆਂ ਦੇ ਵਿਸ਼ੇ ਇੱਕੋ ਹੀ ਵਿਸ਼ਾ ਹੁੰਦਾ ਹੈ ਲੋਰੀ ਦਾ ਕਿ ਮਾਂ ਬੱਚੇ ਨੂੰ ਸੁਣਾਉਂਦੀ ਹੈ ਬੋਲ ਕੇ ਜਿਹਦੇ ਨਾਲ ਛੋਟਾ ਬੱਚਾ ਜਿੰਨਾ ਮਰਜ਼ੀ ਰੋਂਦਾ ਹੋਏ ਉਹ ਆਪਣਾ ਸੌਂ ਜਾਂਦਾ ਹੈ ਅਤੇ ਅੱਗੇ ਅੱਗੇ ਜਨਾਨੀਆਂ ਛੋਟੇ ਹੁੰਦੇ ਪੁਰਾਣੇ ਸਮੇਂ ਦੇ ਵਿੱਚ ਜਨਾਨੀਆਂ ਬੱਚਿਆਂ ਨੂੰ ਸੁਲਾਉਣ ਵਾਸਤੇ ਇਸਦੀ ਹੀ ਮਦਦ ਕਰ ਲੈਂਦੀਆਂ ਸੀ ਛੋਟੇ ਬੱਚੇ ਜਦੋਂ ਬਹੁਤ ਜ਼ਿਆਦਾ ਰੋਂਦਾ ਹੁੰਦਾ ਸੀ ਅਤੇ ਉਸਨੂੰ ਸੁਲਾਉਣ ਵਾਸਤੇ ਲੋਰੀਆਂ ਹੀ ਹੀ ਸੁਣਾਈਆਂ ਜਾਂਦੀਆਂ ਸੀ ਜਿਹਦੇ ਨਾਲ ਬੱਚਾ ਚੁੱਪ ਕਰਕੇ ਬੜੀ ਸੋਹਣੀ ਨੀਂਦ ਸੌਂ ਜਾਂਦਾ ਹੁੰਦਾ ਸੀ ਅੱਜ ਕੱਲ੍ਹ ਤਾਂ ਬੱਚੇ ਭੁੱਲਦੇ ਜਾ ਰਹੇ ਹਨ ਪੁਰਾਣੇ ਸਮੇਂ ਵਿੱਚ ਇੱਕ ਲੋਰੀ ਬਹੁਤ ਯਾਦ ਆਉਂਦੀ ਹੈ ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਹੈ ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਹੈ ਜਾਂ ਇੱਕ ਲੋਰੀ ਹੋਰ ਹੈ ਚੰਦਾ ਮਾਮਾ ਦੂਰ ਕੇ ਚਣੇ ਪਕਾਏ ਪੂਰ ਕੇ ਆਪ ਖਾਓ ਥਾਲੀ ਮੇ ਮੁੰਨੇ ਕੋ ਦੋ ਪਿਆਲੀ ਮੇ ਇਸ ਤਰ੍ਹਾਂ ਦੀਆਂ ਲੋਰੀਆਂ ਬਹੁਤ ਪ੍ਰਚਲਣ ਦੇ ਵਿੱਚ ਸੀ ਅੱਗੇ ਬਹੁਤ ਚੱਲਦੀਆਂ ਹੁੰਦੀਆਂ ਸੀ ਲੋਕ ਮਾਵਾਂ ਮਾਵਾਂ ਉਸਨੂੰ ਉਹਨਾਂ ਨੂੰ ਬਹੁਤ ਇਹ ਬੱਚਿਆਂ ਨੂੰ ਸੁਲਾਉਣ ਲਈ ਹੀ ਇਸ ਦੀ ਵਰਤੋਂ ਕਰਦੀ ਹੁੰਦੀ ਸੀ ਪਰ ਅੱਜ ਕੱਲ੍ਹ ਤਾਂ ਬੱਚੇ ਇਹਨਾਂ ਚੀਜ਼ਾਂ ਨੂੰ ਭੁੱਲਦੇ ਹੀ ਜਾ ਰਹੇ ਹਨ ਇੰਟਰਨੈਟ ਨੇ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਨੂੰ ਬਹੁਤ ਪਿੱਛੇ ਪਾ ਦਿੱਤਾ ਹੋਇਆ ਬੱਚੇ ਨੂੰ ਬਸ ਫੋਨ ਦਿਓ ਅਤੇ ਬੱਚਾ ਸੌਂ ਜਾਂਦਾ ਹੈ